ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਰੰਧਾਵਾ ਆਈਲੈਸ ਸੈਂਟਰ ਤੋਂ ਬੋਲਦੇ ਜੀ ਹਾਂਜੀ ਸਰ ਆਪਾਂ ਜਿੱਦਾਂ ਮਤਲਬ ਕੋਚਿੰਗ ਕਲਾਸਾਂ ਲੈਣੀਆਂ ਸੀਗੀਆਂ ਹਾਂਜੀ ਤੇ ਇਹਦੀ ਫੀਸ ਵਗੈਰਾ ਮੈਨੂੰ ਦੱਸ ਸਕਦੇ ਹੋ ਸਰ ਹਾਂਜੀ ਅੱਛਾ ਜੀ ਅੱਛਾ ਜੀ

ਠੀਕ ਆ ਸਰ ਕਲਾਸ ਕਿੰਨੇ ਚਿਰ ਦੀ ਹੋਊਗੀ ਇਹਦੀ ਘੰਟੇ ਦੀ ਜਾਂ ਕਿੰਨੇ ਚਿਰ ਕਿੰਨੇ ਟਾਈਮ ਦੀ ਦੋ ਘੰਟੇ ਹਾਂਜੀ ਠੀਕ ਆ ਸਰ ਸਰ ਤਾਂ ਜਿੱਦਾਂ ਫੀਸ ਤੁਸੀਂ ਕਹਿੰਦੇ ਪੰਦਰਾਂ ਹਜ਼ਾਰ ਰੁਪਇਆ ਅਤੇ ਇਸ ਤੋਂ ਘੱਟ ਹੋ ਸਕਦੀ ਹੈ ਜਾਂ ਕਿੱਦਾਂ ਹਾਂਜੀ ਠੀਕ ਹੈ ਠੀਕ ਹੈ ਸਰ ਅਤੇ ਇਹ ਸਰ ਕਿੰਨੇ ਤੋਂ ਕਿੰਨੇ ਕਲਾਸ ਹੁੰਦੀ ਆ ਸਰ ਮੈਨੂੰ ਟੋਟਲ ਦੱਸ ਦਿਉ ਮੋਰਨਿੰਗ ਅਤੇ ਈਵਨਿੰਗ ਕਿ ਨਾਈ ਕੀ ਟਾਈਮਿੰਗ ਪੀਰੀਅਡ ਕੀ ਹੈ ਇਹਦਾ ਹਾਂਜੀ ਹਾਂਜੀ ਠੀਕ ਆ ਸਰ ਠੀਕ ਆ ਚਲੋ ਠੀਕ ਆ ਸਰ ਮੈਂ ਠੀਕ ਆ ਸਰ ਮੈਂ ਕੱਲ੍ਹ ਆ ਕੇ ਮਿਲਦਾ ਓਕੇ ਸਰ ਥੈਂਕ ਯੂ